ਪੁਰਾਣੀਆ ਪੀੜ੍ਹੀਆਂ ਛੋਟੀਆਂ ਪੀੜ੍ਹੀਆਂ ਨਾਲੋਂ ਬਹੁਤ ਜ਼ਿਆਦਾ ਧਾਰਮਿਕ ਸਨ ਇਹ ਬਿਲਕੁਲ ਸਹੀ ਹੈ ਕਿਉਂਕਿ ਅੱਜ ਕੱਲ੍ਹ ਦੀ ਪੀੜ੍ਹੀ ਜਿਹੜੀ ਹੈ ਉਹ ਜ਼ਿਆਦਾਤਰ ਮੋਬਾਈਲਾਂ 'ਚ ਜਾਂ ਫਿਰ ਆਪਣੇ ਲੈਪਟੋਪ ਦੇ ਨਾਲ ਹੀ ਬੀਜ਼ੀ ਹਨ ਉਹਨਾਂ ਦੇ ਲਈ ਉਹਨਾਂ ਕੋਲ ਤਾਂ ਇੰਨਾ ਸਮਾਂ ਨਹੀਂ ਹੈ ਕਿ ਉਹ ਜਾ ਕੇ ਮ ਰੋਜ਼ ਹੀ ਮੰਦਿਰ ਜਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਮੱਥਾ ਟੇਕ ਸਕਣ ਪਰ ਸਾਰੇ ਜਿਹੜੇ ਪੁਰਾਣੇ ਲੋਕ ਸਨ ਉਹਨਾਂ ਦਾ ਇੱਕ ਨਿਤਨੇਮ ਹੁੰਦਾ ਸੀ ਉਹਨਾਂ ਦੀ ਰੋਜ਼ ਦੀ ਇੱਕ ਰੂਟੀਨ ਹੁੰਦੀ ਸੀ ਕਿ ਉਹਨਾਂ ਨੇ ਰੋਜ਼ ਸਵੇਰੇ ਵੀ ਜਾਣਾ ਹੈ ਔਰ ਉਹ ਆਪਣੇ ਨਾਲ ਨਾਲ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਂਦੇ ਸਨ ਅਤੇ ਇਹ ਉਹ ਚੀਜ਼ਾਂ ਅੱਜ ਕੱਲ੍ਹ ਦੇ ਬੱਚਿਆਂ 'ਚ ਨਹੀਂ ਦੇਖੀਆਂ ਜਾ ਸਕਦੀਆਂ ਅੱਜ ਕੱਲ੍ਹ ਦੇ ਬੱਚੇ ਸਵੇਰੇ ਉਠਦਿਆਂ ਸਾਰ ਹੀ ਪਹਿਲਾਂ ਸਭ ਤੋਂ ਪਹਿਲਾਂ ਜੋ ਮੈਂ ਦੇਖਿਆ ਮੇਰਾ ਅਨੁਭਵ ਇਹ ਹੈ ਕਿ ਬੱਚੇ ਸਵੇਰੇ ਉਠਦਿਆਂ ਸਾਰ ਹੀ ਸਭ ਤੋਂ ਪਹਿਲਾਂ ਆਪਣੇ ਲਾਗੇ ਪਏ ਮੋਬਾਈਲ ਨੂੰ ਚੁੱਕਦੇ ਹਨ ਜੇ ਉਹਨਾਂ ਨੂੰ ਸਵੇਰੇ ਉਠਾਉਣਾ ਵੀ ਪਵੇ ਤਾਂ ਉਹ ਵੀ ਜਿਹੜਾ ਹੈ ਉਹ ਵੀ ਮੋਬਾਈਲ ਦੀ ਇੱਕ ਅਲਾਰਮ ਦੇ ਨਾਲ ਹੀ ਉੱਠਦੇ ਨੇ ਪਹਿਲਾਂ ਪੁਰਾਣੇ ਲੋਕ ਕੀ ਕਰਦੇ ਸੀ ਆਪਣੇ ਘਰ 'ਚ ਭਜਨ ਲਗਾਉਂਦੇ ਸੀ ਸਵੇਰੇ ਸਵੇਰੇ ਜਾਂ ਲਾਗੇ ਦੇ ਗੁਰਦੁਆਰੇ ਜਾਂ ਕਿਸੇ ਮੰਦਿਰ ਤੋਂ ਸਵੇਰੇ ਸਵੇਰੇ ਭਜਨ ਦੀ ਆਵਾਜ਼ ਆਉਂਦੀ ਸੀ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਹਾਂ ਜੀ ਹੁਣ ਸਵੇਰੇ ਉੱਠ ਕੇ ਮੰਦਰ ਖੁੱਲ੍ਹ ਗਿਆ ਜਾਂ ਗੁਰਦੁਆਰਾ ਖੁੱਲ੍ਹ ਗਿਆ ਆਪਾਂ ਉੱਥੇ ਜਾਣਾ ਬਟ ਹੁਣ ਬੱਚਿਆਂ ਦੇ ਵਿੱਚ ਉਹ ਚੀਜ਼ਾਂ ਨਹੀਂ ਨੇ ਕਿਉਂਕਿ ਇੱਕ ਤਾਂ ਸੋਣਾ ਬਹੁਤ ਲੇਟ ਹੋ ਗਿਆ ਉੱਠਣਾ ਬਹੁਤ ਲੇਟ ਹੋ ਗਿਆ ਉਪਰੋਂ ਬੱਚਿਆਂ ਦਾ ਸਮਾਂ ਜਿਹੜਾ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੇ ਕੋਲ ਕਿਤੇ ਵੀ ਹੋਰ ਐਕਸਟਰਾ ਕੰਮ ਦੇ ਲਈ ਸਮਾਂ ਹੀ ਨਹੀਂ ਹੈਗਾ ਅਤੇ ਉਹ ਇਸ ਕਰਕੇ ਉਹਨਾਂ ਦਾ ਰੁਝਾਨ ਜਿਹੜਾ ਉਹ ਧਾਰਮਿਕ ਚੀਜ਼ਾਂ ਨੂੰ ਹਟਾ ਕੇ ਟੀ ਵੀ ਵੱਲ ਜ਼ਿਆਦਾ ਹੋ ਚੁੱਕਿਆ ਇਸ ਟਾਈਮ 'ਤੇ